ਮੇਰੀ ਮਨਪਸੰਦ ਕਿਤਾਬ ਅਰਦਾਸ ਹੈ ਜੋ ਕਿ ਜਸਵੰਤ ਸਿੰਘ ਨੇਕੀ ਜੀ ਦੀ ਲਿਖੀ ਗਈ ਹੈ ਜਸਵੰਤ ਸਿੰਘ ਨੇਕੀ ਪੀ ਜੀ ਆਈ ਚੰਡੀਗੜ੍ਹ ਦੇ ਡਾਇਰੈਕਟਰ ਹੋਇਆ ਕਰਦੇ ਸਨ ਅਤੇ ਏਮਜ਼ ਵਿੱਚ ਡਿਪਾਰਟਮੈਂਟ ਆਫ ਦੇ ਹੈੱਡ ਆਫ ਦ ਡਿਪਾਰਟਮੈਂਟ ਸਨ ਸੋ ਉਹਨਾਂ ਨੇ ਬੜੀ ਵਧੀਆ ਕਿਤਾਬ ਲਿਖੀ ਹੈ ਅਰਦਾਸ ਦਾ ਪਰੇਅਰ ਉਹਦੇ 'ਚ ਉਹ ਦੱਸਦੇ ਹਨ ਕਿ ਅਰਦਾਸ ਕਰਨ ਵੇਲੇ ਜਾਂ ਪਰੇਅਰ ਕਰਨ ਵੇਲੇ ਭਾਵਨਾ ਕੀ ਹੋਣੀ ਚਾਹੀਦੀ ਹੈ ਔਰ ਅਸੀਂ ਕਿਸ ਅੱਗੇ ਅਰਦਾਸ ਕਰਨੀ ਹੈ ਔਰ ਅ ਵ ਅਰਦਾਸ ਦਾ ਮਹੱਤਵ ਕੀ ਹੈ ਵਟ ਇਜ਼ ਦਾ ਇੰਪੋਰਟੈਂਟ ਔਫ ਪਰੇਅਰ ਇਹ ਪੰਜਾਬੀ ਦੇ ਵਿੱਚ ਕਿਤਾਬ ਵੀ ਹੈ ਇਸਦਾ ਇੰਗਲਿਸ਼ ਅਨੁਵਾਦ ਵੀ ਮਿਲ ਜਾਂਦਾ ਹੈ ਔਰ ਉਸ ਤੋਂ ਬਾਅਦ ਉਹ ਦੱਸਦੇ ਹਨ ਕਿ ਸਾਡੇ ਜਿਹੜੀ ਅਰਦਾਸ ਕਰਨ ਦੀ ਮਰਿਆਦਾ ਕੀ ਹੈ ਆਪਣੀ ਨਿੱਜੀ ਤੌਰ 'ਤੇ ਜਾਂ ਸਾਂਝੀ ਤੌਰ 'ਤੇ ਅਰਦਾਸ ਸਾਨੂੰ ਕਿਵੇਂ ਕਰਨੀ ਚਾਹੀਦੀ ਹੈ ਅਤੇ ਉਸ ਦੇ ਲਈ ਸਾਡੇ ਜੋ ਅੰਦਰਲੀਆਂ ਮਾਨਸਿਕ ਕਠਿਨਾਈਆਂ ਨੇ ਉਹ ਕਿੱਦਾਂ ਦੂਰ ਹੋ ਸਕਦੀਆਂ ਨੇ ਜਾਂ ਹੋਰ ਜਿਹੜਾ ਸਮੱਸਿਆਵਾਂ ਨੇ ਅਰਦਾਸ ਹਰੇਕ ਚੀਜ਼ ਦਾ ਹੱਲ ਹੈ ਦੈਟ ਇਜ਼ ਦਾ ਪਰੇਅਰ ਇਜ਼ ਦਾ ਸਲਿਊਸ਼ਨ ਔਫ ਐਨੀ ਪ੍ਰੋਬਲਮ ਸੋ ਇਸ ਲਈ ਇਹ ਕਿਤਾਬ ਮੈਨੂੰ ਬਹੁਤ ਚੰਗੀ ਲੱਗਦੀ ਹੈ